ਅਸੀਂ ਗਾਉਂਦੇ ਸਮੇਂ ਬੈਂਡ ਅਤੇ ਸਹਿਯੋਗ ਕਿਸੇ ਸਾਥੀ ਦਾ ਸਹਿਯੋਗ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਜੇ ਅਸੀਂ ਇਕੱਲੇ ਗਾਉਂਦੇ ਰਹਾਂਗੇ ਅਤੇ ਉਹਦੇ ਬਾਰੇ ਕਦੇ ਨਹੀਂ ਦੇਖਾਂਗੇ ਅਤੇ ਇਹ ਬਹੁਤ ਗਲਤ ਗੱਲ ਹੋਵੇਗੀ ਅਤੇ ਸਾਹਮਣੇ ਵਾਲੇ ਨੂੰ ਪਸੰਦ ਨਹੀਂ ਆਊਗਾ ਸਾਨੂੰ ਆਪਣੇ ਸਾਥੀ ਨਾਲ ਕੋਰਡੀਨੇਟ ਕਰਕੇ ਚੱਲਣਾ ਚਾਹੀਦਾ ਕਿਉਂਕਿ ਉਹ ਵੀ ਸਾਡੇ ਨਾਲ ਹੀ ਹੈ ਅਤੇ ਉਹਨੂੰ ਉਹਨੇ ਸਾਡੇ ਨਾਲ ਹੀ ਗਾਉਣਾ ਅਤੇ ਜੇ ਜੋ ਬੰਦੇ ਨਾਲ ਅਤੇ ਜੇ ਦੋ ਬੰਦੇ ਨਾਲ ਗਾਵਣ ਅਤੇ ਉਹ ਬਹੁਤ ਵਧੀਆ ਲੱਗਦਾ ਸਾਹਮਣੇ ਵਾਲੇ ਦੇਖਣ ਨੂੰ ਵੀ ਅਤੇ ਬਹੁਤ ਵਧੀਆ ਹੁੰਦਾ ਹੈ ਸਾਨੂੰ ਬਸ ਇੱਦਾਂ ਕੋਪਰੇਟ ਕਰਕੇ ਚੱਲਣਾ ਚਾਹੀਦਾ ਹੈ ਕਿ ਆਪਣਾ ਸਾਨੂੰ ਕੋਪਰੇਟ ਕਰਕੇ ਚੱਲਣਾ ਚਾਹੀਦਾ ਹੈ ਕਿ ਆਪਣਾ ਆਪਣਾ ਕਿ ਬਸ ਇੱਦਾਂ ਚੱਲਣਾ ਚਾਹੀਦਾ ਹੈ ਜਿਵੇਂ ਕਿ ਦੋਵੇਂ ਸਾਥ ਰਹਿਣ ਅਤੇ ਦੋਵੇਂ ਨਾਲ ਸਿੰਗਿੰਗ ਕਰਨ ਅਤੇ ਕੁਛ ਹੋਸ਼ ਪੋਸ਼ ਜਿਹਾ ਨਾ ਲੱਗੇ ਕਿਉਂਕਿ ਜੇ ਸਿੰਗਿੰਗ ਕਰਦੇ ਕਰਦੇ ਅਸੀਂ ਸਾਥੀ ਦਾ ਸਹਿਯੋਗ ਨਹੀਂ ਕਰਾਂਗੇ ਜਾਂ ਕਿਸੇ ਬੈਂਡ ਦਾ ਸਹਿਯੋਗ ਨਹੀਂ ਕਰਾਂਗੇ ਉਹ ਆਪਣਾ ਅਲੱਗ ਕਰਦਾ ਰਹੇਗਾ ਅਸੀਂ ਆਪਣਾ ਅਲੱਗ ਕਰਦੇ ਰਹੀਏ ਫਿਰ ਉਹਦਾ ਕੋਈ ਮਤਲਬ ਨਹੀਂ ਹੋਏਗਾ ਕਿਉਂਕਿ ਸਾਹਮਣੇ ਬੈਠਾ ਬੰਦਾ ਵੀ ਫਿਰ ਸੋਚੇਗਾ ਕਿ ਇਹਨਾਂ ਨੇ ਕੋਈ ਪ੍ਰੈਕਟਿਸ ਨਹੀਂ ਕੀਤੀ ਇਹਨਾਂ ਨੂੰ ਕੁਛ ਕਰਨਾ ਨਹੀਂ ਆਉਂਦਾ ਕਿਉਂਕਿ ਜੇ ਸਾਨੂੰ ਆਉਂਦਾ ਹੈ ਤਾਂ ਸਾਨੂੰ ਉਹਨੂੰ ਪ੍ਰੋਪਰ ਵੇਅ ਨਾਲ ਕਰਨਾ ਚਾਹੀਦਾ ਅਤੇ ਜੇ ਅਸੀਂ ਪ੍ਰੋਪਰ ਵੇਅ ਨਾਲ ਨਹੀਂ ਕਰਾਂਗੇ ਉਹਦੇ ਕਰਨ ਦਾ ਕੋਈ ਫਾਇਦਾ ਨਹੀਂ ਹੈ ਫਿਰ ਸਾਨੂੰ ਸਾਥੀਆਂ ਦਾ ਸਹਿਯੋਗ ਕਰਕੇ ਚੱਲਣਾ ਚਾਹੀਦਾ ਹੈ ਬੈਂਡ ਦਾ ਵੀ ਸਹਿਯੋਗ ਕਰਨਾ ਚਾਹੀਦਾ ਅਤੇ ਇਸ ਨਾਲ ਕਾਫ਼ੀ ਵਧੀਆ ਲੱਗੇਗੀ ਸਾਡੀ ਸਿੰਗਿੰਗ ਕਿਉਂਕਿ ਜੇ ਅਸੀਂ ਬੈਂਡ ਨਾਲ ਕੋਪਰੇਟ ਨਹੀਂ ਕਰਾਂਗੇ ਤਾਂ ਫਿਰ ਸ ਇਕੱਲੀ ਆਵਾਜ਼ ਲੋਕ ਨਹੀਂ ਸੁਣਦੇ ਲੋਕਾਂ ਨੂੰ ਵ ਗਾਣੇ ਵਿੱਚ ਮਿਊਜ਼ਿਕ ਵੀ ਚਾਹੀਦਾ ਹੁੰਦਾ ਹੈ ਕਿਸੇ ਦੂਸਰੇ ਬੰਦੇ ਦੀ ਅਵਾਜ਼ ਵੀ ਚਾਹੀਦੀ ਹੁੰਦੀ ਹੈ ਅਤੇ ਇਹੀ ਸਾਰੇ ਕਾਰਨ ਕਰਕੇ ਹੀ ਗਾਣਾ ਬਣਦਾ ਹੈ ਅਤੇ ਜੇ ਅਸੀਂ ਬੈਂਡ ਨਾਲ ਅਤੇ ਸਾਥੀ ਨਾਲ ਸਹਿਯੋਗ ਨਹੀਂ ਕਰਾਂਗੇ ਤਾਂ ਗਾਣਾ ਵਧੀਆ ਨਹੀਂ ਲੱਗੇਗਾ ਅਤੇ ਕੋਈ ਵੀ ਨਹੀਂ ਸੁਣੇਗਾ ਤਾਂ ਕਿ ਬਟ ਜੇ ਅਸੀਂ ਬੈਂਡ ਅਤੇ ਸਾਥੀ ਨਾਲ ਪ੍ਰੋਪਰ ਸਹਿਯੋਗ ਕਰਕੇ ਚੱਲਾਂਗੇ ਤਾਂ ਸਾਹਮਣੇ ਵਾਲੇ ਨੂੰ ਬਹੁਤ ਵਧੀਆ ਲੱਗੇਗਾ ਗਾਣਾ ਕਿ ਇਹ ਗਾਉਣ ਵਾਲੇ ਬੰਦੇ ਨੇ ਬਹੁਤ ਵਧੀਆ ਗਾਇਆ ਹੈ ਇਹੀ ਮੈਂ ਕਹਿਣਾ ਚਾਹੁੰਦਾ ਜਿਹੜੇ ਵੀ ਸਿੰਗਰਸ ਨੇ ਕਿ ਆਪਣੇ ਪਾਟਨਰਜ਼ ਨਾਲ ਸਹਿਯੋਗ ਕਰਕੇ ਚੱਲਣ ਜੇ ਕੋਈ ਬੈਂਡ ਹੈਗਾ ਉਹਦੇ ਨਾਲ ਸਹਿਯੋਗ ਕਰਕੇ ਚੱਲਣ ਕਦੇ ਵੀ ਇਕੱਲੇ ਪ੍ਰਫੋਰਮ ਨਾ ਹੀ ਕਰਨਾ ਚਾਹੀਦਾ ਕਦੇ ਵੀ ਜੇ ਤੁਹਾਡੇ ਕੋਲ ਜੇ ਸਾਡੇ ਨਾਲ ਕੋਈ ਪਾਟਨਰ ਹੈ ਜਾਂ ਬੈਂਡ ਹੈ ਕਦੇ ਵੀ ਸੋਲੋ ਪ੍ਰਫੋਰਮਸ 'ਤੇ ਨਹੀਂ ਜਾਣਾ ਚਾਹੀਦਾ ਸਾਨੂੰ ਹਮੇਸ਼ਾ ਕੋਪਰੇਟ ਕਰਕੇ ਮੋਟੀਵੇਟ ਕਰਕੇ ਚੱਲਣਾ ਚਾਹੀਦਾ ਹੈ ਅਤੇ ਸਾਨੂੰ ਦੇਖਣਾ ਚਾਹੀਦਾ ਹੈ ਕਿ ਸਾਡੇ ਆਸ ਪਾਸ ਕੀ ਹੋ ਰਿਹਾ ਹੈ ਅਤੇ ਉਹ ਕਿਹੜੇ ਪੇਸ 'ਤੇ ਚੱਲ ਰਿਹਾ ਹੈ ਅਤੇ ਤੁਸੀਂ ਕਿਹੜੇ ਪੇਸ ਚੱਲ ਰਹੇ ਹੋ ਅਤੇ ਦੋਨਾਂ ਦੀ ਸਿੰਗਿੰਗ ਦੀ ਪੇਸ ਅਤੇ ਟੋਨ ਦੇ ਸਭ ਕੁਛ ਮੈਚ ਕਰਨਾ ਚਾਹੀਦਾ ਤਾਂ ਹੀ ਇੱਕ ਪ੍ਰੋਪਰ ਗਾਣਾ ਲੱਗੇਗਾ ਅਤੇ ਉਹੀ ਗੱਲ ਹੈ ਫਿਰ ਸਾਨੂੰ ਕਿ ਸਿੰਗਿੰਗ ਬਹੁਤ ਇਹੋ ਜਿਹੇ ਕ ਬਹੁਤ ਲੋਕਾਂ ਨੂੰ ਸਿੰਗਿੰਗ ਕਾਫ਼ੀ ਈਜੀ ਲੱਗਦੀ ਬਟ ਓਨੀ ਈਜੀ ਹੈ ਨਹੀਂ ਕਿਉਂਕਿ ਸ ਸਾਨੂੰ ਸਾਡੇ ਗਲੇ ਦੀ ਸਥਿਤੀ ਕਾਫ਼ੀ ਵਧੀਆ ਰੱਖਣੀ ਪੈਂਦੀ ਹੈ ਸਾਨੂੰ ਹਮੇਸ਼ਾ ਠੀਕ ਰਹਿਣਾ ਪੈਂਦਾ ਹੈ ਅਤੇ ਗਲ ਜੇ ਮਾੜਾ ਜਿਹਾ ਗਲਾ ਖਰਾਬ ਹੋਇਆ ਤਾਂ ਅਵਾਜ਼ ਵਿੱਚ ਫ਼ਰਕ ਪੈ ਜਾਂਦਾ ਹੈ ਅਤੇ ਅਸੀਂ ਸਿੰਗਿੰਗ ਠੀਕ ਤਰ੍ਹਾਂ ਨਹੀਂ ਕਰ ਸਕਦੇ